ਸਤਿ ਸ਼੍ਰੀ ਅਕਾਲ ਸਰ ਜੀ ਮੈਂ ਰਿਤੂ ਬਾਲਾ ਪਠਾਨਕੋਟ ਤੋਂ ਬੋਲਦੀ ਹਾਂ ਅਤੇ ਪਿਛਲੀ ਵਾਰ ਮੇਰੇ ਬੱਚਿਆਂ ਦਾ ਬਰਥਡੇ ਸੀ ਮੈਂ ਖਾਣਾ ਮੰਗਵਾਇਆ ਸੀ ਤੁਹਾਡੇ ਕੋਲੋਂ ਅਤੇ ਤੁਸੀਂ ਉਹਦੇ ਵਿੱਚ ਨਾ ਮੈਨੂੰ ਸੌ ਰੁਪਇਆ ਛੂਟ ਦਿੱਤੀ ਸੀ ਪੀਜ਼ਾ ਬਰਗਰ ਮੰਗਵਾਇਆ ਸੀ ਨੂਡਲ ਕੁਛ ਇਸ ਤਰ੍ਹਾਂ ਮੰਗਵਾਇਆ ਸੀ ਅਤੇ ਤੁਸੀਂ ਵਿੱਚ ਛੂਟ ਦਿੱਤੀ ਸੀ ਅਤੇ ਹੁਣ ਮੈਂ ਖਾਣਾ ਮੰਗਵਾਉਣਾ ਚਾਹੁੰਦੀ ਹਾਂ ਅਤੇ ਮਲ ਕਿ ਉਹਦੇ ਵਿੱਚ ਮਲ ਕਿ ਤੁਸੀਂ ਉਹ ਵਾਲਾ ਕੁਪਨ ਲਗਾ ਕੇ ਤੁਸੀਂ ਮਲ ਕਿ ਸਾਨੂੰ ਛੂਟ ਦੇਣਾ ਚਾਹੁੰਦੇ ਹੋ ਮੈਂ ਮੇਰੇ ਮਲ ਕਿ ਬੱਚਿਆਂ ਦਾ ਰਿਜ਼ਲਟ ਆਇਆ ਨੰਬਰ ਠੀਕ ਠਾਕ ਆਏ ਆ ਅਤੇ ਮੈਂ ਖੁਸ਼ੀ ਨਾਲ ਔਡਰ ਕਰਨਾ ਚਾਹੁੰਦੀ ਹਾਂ ਤੁਸੀਂ ਜਿਹੜਾ ਪਿਛਲੀ ਵਾਰੀ ਮਲ ਕਿ ਛੂਟ ਦਿੱਤੀ ਸੀ ਸੌ ਰੁਪਇਆ ਅਤੇ ਹੁਣ ਸਾਡਾ ਬਿਲ ਮਲ ਕਿ ਬਿਲ ਪੰਜ ਸੌ ਰੁਪਇਆ ਆ ਰਿਹਾ ਉਹ ਘਟਾਉਣਾ ਚਾਹੁੰਦੇ ਹੋ ਤਾਂ ਸਾਡਾ ਮਲ ਕਿ ਉਹ ਲਾ ਕੇ ਅਤੇ ਸਾਨੂੰ ਖਾਣੇ ਦੇ ਔਡਰ ਦੇ ਦਿਉ